ਅਸੀਂ ਆਪਣੇ ਘਰ ਵਿੱਚ ਬਹੁਤ ਤਰ੍ਹਾਂ ਦੇ ਜੜ੍ਹੀ ਬੂਟੀਆਂ ਅਤੇ ਪੌਦੇ ਲਗਾਏ ਹਨ ਜਿਹਨਾਂ ਨਾਲ ਬਹੁਤ ਵਧੀਆ ਰਹਿੰਦੀਆਂ ਹਨ ਕਿਉਂਕਿ ਗੋਭੀ ਸਾਰੀ ਸਬਜ਼ੀਆਂ ਮੇਥੀ ਧਨੀਆਂ ਪਾਲਕ ਸਾਰੇ ਯਾਨੀ ਕਿ ਪੌਦੇ ਖਾਣ ਪੀਣ ਵਾਲੇ ਲਗਾਏ ਜਾਂਦੇ ਹਨ ਫੁੱਲ ਗੁਲਾਬ ਦੇ ਕਿਆਰੀਆਂ ਬਣਾ ਬਣਾ ਕੇ ਲਗਾਏ ਹਨ ਇਹ ਸਾਨੂੰ ਬਹੁਤ ਚੰਗੇ ਲੱਗਦੇ ਹੈ ਕਿਉੰਕਿ ਹਰਿਆਲੀ ਦਿੰਦੇ ਹਨ